ਹੈਲੋ ਸਤਿ ਸ਼੍ਰੀ ਕਾਲ ਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਕੋਈ ਗੱਲ ਨਹੀਂ ਮੈਂ ਦੱਸ ਦਿੰਦੀ ਹਾਂ ਸਾਡੇ ਇੱਥੇ ਲਾਗੇ ਹੀ ਬੱਸ ਸਟੈਂਡ ਹੈਗਾ ਹੈ ਚੰਡੀਗੜ੍ਹ ਚੌਂਕ ਦੇ ਲਾਗੇ ਹੈਗਾ ਹੈ ਮੰਡੀ ਸਬਜ਼ੀ ਮੰਡੀ ਹੈਗੀ ਹੈ ਨਵਾਂ ਸ਼ਹਿਰ 'ਚ ਹਾਂਜੀ ਉੱਥੇ ਮੈਮ ਫਰੈਸ਼ ਸਬਜ਼ੀਆਂ ਮਿਲ ਜਾਣੀਆਂ ਸ਼ਾਮ ਨੂੰ ਮੰਡੀ ਲੱਗਦੀ ਆ ਤਿੰਨ ਵਜੇ ਤੋਂ ਸਟਾਰਟ ਹੋ ਜਾਂਦੀ ਹੈ ਰਾਤ ਦੇ ਨੌ ਵਜੇ ਤੱਕ ਮਤਲਬ ਕਿ ਰਹਿੰਦੇ ਆ ਅਤੇ ਆਪਾਂ ਇੱਦਾਂ ਜੇ ਉੱਥੇ ਜਾ ਕੇ ਜੇ ਫਰੈਸ਼ ਲੈਣੀ ਹੋਵੇ ਤਾਂ ਫਿਰ ਆਪਾਂ ਉੱਥੇ ਮਤਲਬ ਕਿ ਟਾਈਮ ਨਾਲ ਜਿਵੇਂ ਉਹ ਤਿੰਨ ਵਜੇ ਆ ਜਾਂਦੇ ਹੈ ਆਪਾਂ ਚਾਰ ਵਜੇ ਉੱਥੇ ਵਿਜ਼ੀਟ ਕਰ ਸਕਦੇ ਹਾਂ ਅਤੇ ਸਾਨੂੰ ਮਤਲਬ ਕਿ ਤਾਜ਼ੀ ਤਾਜ਼ੀ ਸਬਜ਼ੀ ਮਿਲ ਜਾਣੀ ਕਿਉਂਕਿ ਜੇ ਆਪਾਂ ਜਿੱਦਾਂ ਰਾਤ ਨੂੰ ਜਾਵਾਂਗੇ ਥੋੜ੍ਹੀ ਮਤਲਬ ਕਿ ਹੋ ਜਾਂਦਾ ਹੈ ਫਿਰ ਤਾਜ਼ੀ ਸਬਜ਼ੀ ਰਹਿੰਦੀ ਨਹੀਂ ਥੋੜ੍ਹੀ ਫਿਰ ਹੋ ਜਾਂਦੀ ਨਾ ਥੋੜ੍ਹੀ ਬੇਹੀ ਜਿਹੀ ਹੋ ਜਾਂਦੀ ਆ ਹਾਂਜੀ ਹਾਂਜੀ ਹਾਂਜੀ ਮੈਮ ਕੋਈ ਨਾ ਤੁਸੀਂ ਆ ਜਿਓ ਕਿਸ ਦਿਨ ਜਾਣਾ ਸੀਗਾ ਤੁਸੀਂ ਕਦੋਂ ਜਾਣਾ ਮੈਨੂੰ ਦੱਸ ਦਿੰਦੇ ਕੱਲ੍ਹ ਸਹੀ ਮੈਮ ਸ਼ਾਮ ਮੈਂ ਤੁਹਾਨੂੰ ਇੱਕ ਵਾਰੀ ਕੋਲ ਤੁਸੀਂ ਮੈਨੂੰ ਇੱਕ ਇੱਦਾਂ ਕਰਿਉ ਤੁਸੀਂ ਮੈਨੂੰ ਇੱਕ ਵਾਰੀ ਕੋਲ ਕਰਕੇ ਪੁੱਛ ਲਿਓ ਹਾਂਜੀ ਵੀ ਜੇ ਮੈਂ ਫਰੀ ਹੋਈ ਤਾਂ ਮੈਂ ਤੁਹਾਨੂੰ ਕੋਈ ਗੱਲ ਨਹੀਂ ਜ਼ਰੂਰ ਵਿਜਿਟ ਕਰ ਲਵਾਂਗੇ ਠੀਕ ਹੈ ਮੈਮ ਕੋਈ ਗੱਲ ਨਹੀਂ ਐਵੇਂ ਕਰ ਦਿੰਦੇ ਠੀਕ ਹੈ ਜੀ ਓਕੇ ਠੀਕ ਹੈ ਥੈਂਕ ਯੂ